ਹਾਂਜੀ ਚੱਡਾ ਫਰਨੀਚਰ ਜੀ ਹਾਂਜੀ ਮੈਡਮ ਸ ਸਾਨੂੰ ਨਾ ਅ ਬੈੱਡ ਦੀ ਰਿਕੁਆਇਰਮੈਂਟ ਹੈ ਅਤੇ ਤੁਹਾਡੇ ਕੋਲ ਕਿਹੜਾ ਕਿਹੜਾ ਮਟੀਰੀਅਲ ਹੈ ਟਾਹਲੀ ਦੀ ਲੱਕੜੀ ਦਾ ਬੈੱਡ ਮਿਲਜੂ ਜਾਂ ਨਹੀਂ ਅਤੇ ਉਹਦਾ ਪ੍ਰਾਈਸ ਰੇਂਜ ਕੀ ਹੈ ਕਿੰਨਾ ਕੁ ਪ੍ਰਾਈਜ਼ ਆ ਜੀ ਉਹਦਾ ਅੱਛਾ ਉਹਦੇ ਵਿੱਚ ਉਹ ਓ ਫਰਨੀਸ਼ਿੰਗ ਹੈ ਜਾਂਂ ਸਿਰਫ ਉਹਦੇ 'ਤੇ ਉਹ ਜਿਵੇਂ ਸਿਨਮਾਇਕਾ ਲੱਗਦਾ ਹੁੰਦਾ ਉਹ ਹੈ ਜਾਂ ਦੂਜਾ ਪੋਲਿਸ਼ ਵਾਲਾ ਵੀ ਮਿਲ ਜੂਗਾ ਓਕੇ ਅਤੇ ਅੱਜ ਕੱਲ੍ਹ ਇੱਕ ਉਹ ਸੇ ਨਾਲ ਸੈੱਟੀਆਂ ਵੀ ਹੁੰਦੀਆਂ ਨੇ ਉਹ ਵੀ ਸੈੱਟੀਆਂ ਵੀ ਨਾਲ ਨੇ ਜਾਂ ਨਹੀਂ ਓਕੇ ਅੱਛਾ ਉਹਦੇ ਵਾਸਤੇ ਸਾਨੂੰ ਵਾਧੂ ਪੈਸੇ ਦੇਣੇ ਪੈਣਗੇ ਕਿ ਜਾਂ ਵਿੱਚ ਹੀ ਆ ਇੰਨਕਲੂਡ ਉਹ ਅੱਛਾ ਉਹ ਸੈੱਟ ਟੂ ਸੈੱਟ ਅੱਛਾ ਓਕੇ ਓਕੇ ਉਹ ਸੈੱਟ ਟੂ ਸੈੱਟ ਡਿਜ਼ਾਇਨ ਦੇ ਅਕੋਰਡਿੰਗ ਡਿਪੈਂਡ ਕਰਦਾ ਵੀ ਕਿਹੜੇ ਅੱਛਾ ਅੱਛਾ ਠੀਕ ਹੈ ਜੀ ਠੀਕ ਹੈ ਇਸ ਤੋਂ ਇਲਾਵਾ ਡਾ ਡਾਇਨਿੰਗ ਟੇਬਲ ਵੀ ਹੈ ਜਾ ਅੱਛਾ ਉਹ ਗਲਾਸ ਵਾਲੇ ਵੀ ਮਿਲ ਜਾਣਗੇ ਜੀ ਗਲਾਸ ਵਾਲੇ ਅੱਜ ਕੱਲ੍ਹ ਚੱਲਦੇ ਨੇ ਨਾ ਬਹੁਤ ਵਧੀਆ ਲੱਗਦੇ ਨੇ

ਅੱਛਾ ਜੀ ਉਹਦਾ ਕਿੰਨਾ ਕੁ ਮੁੱਲ ਹੋਊਗਾ ਜੀ ਅੱਸੀ ਕੁ ਹਜ਼ਾਰ ਜਾਂ ਇੱਕ ਲੱਖ ਜੀ ਅੱਛਾ ਅੱਛਾ ਜੀ ਜਿਵੇਂ ਜਿਵੇਂ ਵ ਵਧੂਗਾ ਓਵੇਂ ਓਵੇਂ ਮੁੱਲ ਵਧੀ ਜਾਊਗਾ ਜੀ ਠੀਕ ਹੈ ਠੀਕ ਹੈ ਠੀਕ ਹੈ ਜੀ ਇਹ ਟਾਹਲੀ ਦੀ ਲੱਕੜ ਵਾਲਾ ਜੀ ਕਿ ਨਹੀਂ ਦੂ ਦੂਜਾ ਮਿਲ ਜਾਊਗਾ ਟਾਹਲੀ ਦੀ ਲੱਕੜ ਵਾਲਾ ਮਿਲ ਜੂਗਾ ਜੀ ਠੀਕ ਹੈ ਜੀ ਠੀਕ ਹੈ ਠੀਕ ਹੈ ਮੈਡਮ ਜੀ ਚਲੋ ਜਦੋਂ ਵੀ ਸਾਡੀ ਰਿਕੁਆਇਰਮੈਂਟ ਹੋਊਗੀ ਤੁਹਾਨੂੰ ਕੋਂਟੈਕਟ ਦੁਬਾਰਾ ਕਰਾਂਗੇ ਠੀਕ ਹੈ ਓਕੇ ਧੰਨਵਾਦ ਜੀ